ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਕੰਪਨੀ ਦਾ ਮੋਬਾਈਲ ਖਰੀਦਿਆ ਸੀ ਅਤੇ ਮੈਨੂੰ ਬਹੁਤ ਪਸੰਦ ਆਇਆ ਇਸ ਦਾ ਪੈਕਿੰਗ ਬਹੁਤ ਸੋਹਣੀ ਕੀਤੀ ਹੋਈ ਸੀ ਅਤੇ ਇਸ ਦਾ ਕੈਮਰਾ ਬਹੁਤ ਵਧੀਆ ਚੱਲਦਾ ਹੈ ਇਸ ਦੀ ਕਲੈਰਟੀ ਬਹੁਤ ਜ਼ਿਆਦਾ ਏ ਅਤੇ ਇਸ ਦੀ ਆਵਾਜ਼ ਬਹੁਤ ਸੋਹਣੀ ਹੈ ਅਤੇ ਮੇਰੇ ਦੋਸਤਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਇਆ ਹੈ